ਗਿਆਰ੍ਹਾਂ ਦੋ ਸੌ ਪੱਚੀ ਚਾਰ ਹਜ਼ਾਰ ਪੰਜ ਸੌ ਛਿਆਹਠ ਇੱਕੀ ਹਜ਼ਾਰ ਦੋ ਸੌ ਸਤਾਸੀ ਨੌਂ ਲੱਖ ਸਤਾਸੀ ਹਜ਼ਾਰ ਪੰਜ ਸੌ ਤਰੇਂਹਠ